ਮੇਰੇ ਵਿਚਾਰ ਨਾਲ ਅੱਜ ਕੱਲ੍ਹ ਕਾਫੀ ਤਕਨੀਕਸ ਜੋ ਕਿ ਆ ਚੁੱਕੀਆਂ ਨੇ ਜਿਵੇਂ ਕਿ ਫਸਟਅਫ ਏ ਆਈ ਨੇ ਏ ਆਈ ਟੈਕਨੋਲੋਜੀ ਹੈ ਆਰਟੀਫਿਸ਼ੀਅਲ ਟ ਇੰਟੈਲੀਜੈਂਸੀ ਜਿਹਦੇ ਵਿੱਚ ਕਿ ਆ ਕਾਫੀ ਅ ਐਡਵਾਂਸ ਹੈ ਉਹ ਮਸ਼ੀਨ ਕੁਇੱਕ ਲਰਨਰ ਹੈ ਜਲਦੀ ਪ੍ਰੋਸੈਸ ਕਰਦੇ ਆ ਨੈਚੁਰਲ ਲੈਂਗੁਏਜ ਪ੍ਰੋਸੈਸਿੰਗ ਆ ਜਿਵੇਂ ਕਿ ਉਸਨੂੰ ਕਾਫੀ ਲੈਂਗੁਏਜਸ ਵੀ ਅ ਮਤਲਬ ਕਿ ਆ ਆਉਂਦੀ ਹੁੰਦੀ ਆ ਕੰਪਿਊਟਰ ਵਿਜ਼ਨ ਹੈ ਇਹ ਕਾਫੀ ਹੈਲਪਫੁਲ ਹੁੰਦੀ ਹੈ ਅੱਜ ਕੱਲ੍ਹ ਦੇ ਲੋਕਾਂ ਲਈ ਕਾਫੀ ਮਦਦਗਾਰ ਹੈ ਅਗਰ ਆਪਾਂ ਇਸ ਨੂੰ ਅਪਲਾਈ ਕਰੀਏ ਅਤੇ ਵਰਚੁਅਲ ਪਰਸਨਲ ਅਸਿਸਟੈਂਟ ਵੀ ਹੈ ਇੰਟੈਲੀਜੈਂਟ ਚੈਟਬੋਡ ਵੀ ਹੈ ਅਤੇ ਇਸ ਦੇ ਨਾਲ ਹੀ ਔਟੋਮੈਟਿਡ ਕਸਟਮਰ ਸਰਵਿਸ ਵੀ ਹੈ ਇਸ ਨਾਲ ਆ ਅਸੀਂ ਕਾਫੀ ਹੈਲਪਫੁਲ ਹੁੰਦੇ ਹਾਂ ਕਾਫੀ ਇਸਦੀ ਮਦਦ ਨਾਲ ਮਦਦ ਲੈ ਸਕਦੇ ਹਾਂ ਅਤੇ ਫਿਰ ਇੱਕ ਹੋਰ ਵੀ ਆ ਜਿਵੇਂ ਕਿ ਇੰਟਰਨੈੱਟ ਔਫ ਥਿੰਗਸ ਜਿਸ ਨਾਲ ਆਪਾਂ ਕੀ ਕਿਤੇ ਵੀ ਹੋਈਏ ਤਾਂ ਅਸੀਂ ਇੰਟਰਨੈੱਟ ਦੇ ਨਾਲ ਆਪਣੇ ਹੋਮ ਜਾਂ ਕੁਛ ਮਸ਼ੀਨਸ ਜਿਵੇਂ ਕੁਛ ਵੀ ਅਗਰ ਕੰਮ ਹੈ ਯਾਂ ਫੈਨ ਵਗੈਰਾ ਕੁਛ ਵੀ ਹੈ ਜੋ ਕਨੈਕਟ ਕਰ ਸਕਦੇ ਹਾਂ ਅਤੇ ਕਦੇ ਵੀ ਉਹਨਾਂ ਨੂੰ ਸਵਿਚ ਔਫ ਜਾਂ ਔਨ ਕਰ ਸਕਦੇ ਹਾਂ ਅਗਰ ਆਪਾਂ ਕਿਤੇ ਗਏ ਵੀ ਹੋਏ ਹਾਂ ਤਾਂ ਹਮ ਵੈਬ ਕੈਮਰਾਸ ਨਾਲ ਕਿ ਆਪਣੀ ਸਕਿਓਰਟੀ ਹੋਮ ਦੀ ਚੈੱਕ ਕਰ ਸਕਦੇ ਹਾਂ ਵਿਦ ਵਿਦ ਫ਼ੋਨ ਕਿ ਫ਼ੋਨ ਦੇ ਨਾਲ ਕਨੈਕਟ ਕਰਕੇ ਅਤੇ ਇੱਕ ਜਿਵੇਂ ਕਿ ਬਲੋਕ ਚੈਨ ਹੈ ਉਹ ਸਾਡੀ ਡਾਟਾ ਸਕਿਉਰਟੀ ਲਈ ਹੁੰਦਾ ਹੈ ਜਿਵੇਂ ਕਿ ਸਕਿਉਰਟੀ ਲੇਕਿਨ ਮੰਨ ਲਓ ਅਗਰ ਕਿਸੀ ਵਕਤ ਕਿ ਕੋਈ ਜੋ ਹੈਕਰ ਅਗਰ ਹਮ ਮਤਲਬ ਸਾਡਾ ਅਕਾਊਂਟ ਦਾ ਪਾਸਵਰਡ ਹੈਕ ਕਰ ਲਵੇ ਅਤੇ ਉਹ ਤਾਂ ਵੀ ਸਾਡੇ ਅਕਾਊਂਟ ਨੂੰ ਨਹੀਂ ਖੋਲ੍ਹ ਸਕਦਾ ਕਿਉਂਕਿ ਬਲੋਕਚੈਨ ਦੇ ਵਿੱਚ ਉਸਨੂੰ ਬਾਰ ਬਾਰ ਕਾਫੀ ਪਾਸਵਰਡ ਪਤਾ ਕਰਨੇ ਪੈਣਗੇ ਜੋ ਕਿ ਪੌਸੀਬਲ ਨਹੀਂ ਹੋਏਗਾ ਉਹ ਸਿਰਫ ਅਸੀਂ ਹੀ ਖੋਲ੍ਹ ਸਕਦੇ ਹਾਂ ਥੈਂਕ ਯੂ